ਹੋਰ ਬਾਈ ਕੀ ਹਾਲ ਹੈ ਮੈਂ ਤੈਨੂੰ ਦੱਸ ਰਿਹਾ ਸੀਗਾ ਨਾ ਜੋ ਮੈਂ ਹੈੱਡਫੋਨ ਔਡਰ ਕੀਤੇ ਸੀਗਾ ਲਾਸਟ ਸੈਟਰਡੇ ਨੂੰ ਬਾਈ ਉਹਦੇ ਬਾਰੇ ਦੱਸ ਰਿਹਾ ਹਾਂ ਕਿ ਬਹੁਤ ਹੀ ਵਧੀਆ ਸੀਗਾ ਅੱਗੇ ਜੋ ਰੇਟ ਆ ਉਹਦਾ ਉਹ ਰੇਟ ਵੀ ਬਹੁਤ ਹੀ ਜ਼ਿਆਦਾ ਕੰਫਰਟੇਬਲ ਐਂਡ ਰੀਜਨੇਬਲ ਆ ਚੂ ਉਸਦੀ ਸਾਊਂਡ ਕੁਆਲਿਟੀ ਵੀ ਇਕਦਮ ਲਾਜਵਾਬ ਆ ਐਂਡ ਬਾਸ ਕੁਆਲਿਟੀ ਵੀ ਉਸਦਾ ਡਿਜ਼ਾਈਨ ਜਿਹੜਾ ਉਹ ਵੀ ਅਲਟੀਮੇਟ ਆ ਕੰਨਾਂ ਵਿੱਚ ਪਾਏ ਤੈਨੂੰ ਵੀ ਬਹੁਤ ਜ਼ਿਆਦਾ ਜੱਚਣਗੇ ਮੈਂ ਉਹ ਪਾ ਕੇ ਸਟਾਈਲ ਦਾ ਕੰਮ ਵੀ ਕਰ ਸਕਦਾ ਹਾਂ ਅਗਰ ਅਤੇ ਅਰਮਾਨ ਨਾਲ ਫ਼ੋਨ ਆਪਣੇ ਜੇਬ ਵਿੱਚ ਪਾ ਕੇ ਉਹਨਾਂ ਨੂੰ ਕੰਨਾਂ 'ਤੇ ਲਾ ਕੇ ਕਿਸੇ ਨਾਲ ਗੱਲ ਕਰਨੀ ਹੋਵੇ ਗੱਲ ਵੀ ਕਰ ਸਕਦਾ ਉਹਦੀ ਸਾਊਂਡ ਕੁਆਲਿਟੀ ਅਲਟੀਮੇਟ ਆ ਗੱਲ ਕਰਨ ਵਾਸਤੇ ਵੀ ਔਰ ਅਤੇ ਮਿਊਜ਼ਿਕ ਵਾਸਤੇ ਵੀ ਮਿਊਜ਼ਿਕ ਸੁਣਦੇ ਟਾਈਮ ਉਹਦੀ ਬਾਸ ਕੁਆਲਿਟੀ ਵੀ ਬੜੀ ਜ਼ਿਆਦਾ ਵੱਧ ਜਾਂਦੀ ਹੈ ਅਤੇ ਵੋਲਿਅਮ ਦੇ ਨਾਲ ਨਾਲ ਉਹਨੂੰ ਉੱਥੋਂ ਦੀ ਹੀ ਕੰਟਰੋਲ ਹੋ ਜਾਂਦਾ ਕੰਨਾਂ ਦੇ ਸੈਂਸ ਹੈੱਡਫੋਨਾਂ ਦੇ ਉੱਤੇ ਹੀ ਸੈਂਸਰ ਲੱਗੇ ਹੋਏ ਹਨ ਜਿਹੜੇ ਕੰਨਾਂ ਦੇ ਲਾਏ ਲਾਏ ਹੀ ਆਪਾਂ ਯੂਜ਼ ਕਰ ਸਕਦੇ ਹਾਂ ਅਤੇ ਉਹਦੀ ਵੋਲਿਅਮ ਨੂੰ ਅੱਪ ਐਂਡ ਡਾਊਨ ਵੀ ਕਰ ਸਕਦੇ ਹਾਂ ਮੈਂ ਮੇਰੀ ਮੰਨ ਤੂੰ ਵੀ ਮੰਗਵਾ ਲੈ ਅਤੇ ਇਸ ਟਾਈਮ ਔਫਰ ਚੱਲ ਰਹੀ ਹੈ ਜੋ ਕਿ ਸਹੀ ਰੇਟ 'ਤੇ ਮਿਲ ਰਹੇ ਹਨ ਮੈਂ ਤੈਨੂੰ ਵੀ ਪ੍ਰੈਫਰ ਇਹੀਓ ਕਰਾਂਗਾ ਕਿ ਜਿੰਨੀ ਜਲਦੀ ਹੋ ਸਕੇ ਔਡਰ ਕਰ ਲਾ ਅਗਰ ਤੇਰੇ ਕੋਲ ਕ੍ਰੈਡਿਟ ਕਾਰਡ ਨਹੀਂ ਹੈ ਤਾਂ ਕ੍ਰੈਡਿਟ ਕਾਰਡ ਤੂੰ ਮੇਰਾ ਯੂਜ਼ ਕਰ ਸਕਦਾ ਆ ਪਰ ਔਡਰ ਕਰ ਲਾ ਆਪਣੇ ਵਾਸਤੇ ਵੀ ਅਤੇ ਆਪਣੇ ਘਰਦਿਆਂ ਵਾਸਤੇ ਵੀ